ਸਾਡੇ ਰਾਜ ਵਿੱਚ ਟੈਲੀਮੈਡੀਸਨ ਦੀ ਵਰਤੋਂ ਕੁਝ ਇਸ ਪ੍ਰਕਾਰ ਕੀਤੀ ਜਾਂਦੀ ਹੈ ਕਿ ਜਿਵੇਂ ਅੱਜ ਕੱਲ੍ਹ ਲੋਕ ਘਰ ਬਿਮਾਰ ਹੋ ਜਾਂਦੇ ਹਨ ਜਾਂ ਕਿਸੇ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤਾਂ ਉਹ ਅੱਜ ਕੱਲ੍ਹ ਔਨਲਾਈਨ ਗੂਗਲ ਉੱਤੇ ਡਾਕਟਰਾਂ ਨੇ ਜਾਂ ਕਿਸੇ ਵੀ ਪ੍ਰਕਾਰ ਦੇ ਹੋਸਪਿਟਲ ਵਿੱਚ ਆਪਾਂ ਉਹਨਾਂ ਨੇ ਉੱਥੇ ਆਪਣੇ ਨੰਬਰ ਜਾਰੀ ਕੀਤੇ ਹੁੰਦੇ ਹਨ ਉਹਨਾਂ ਨੇ ਆਪਣੀਆਂ ਅਲੱਗ ਅਲੱਗ ਵੈੱਬਸਾਈਟਾਂ ਬਣਾਈਆਂ ਹੁੰਦੀਆਂ ਹਨ ਜਿਨ੍ਹਾਂ ਦੇ ਦੌਰਾਨ ਆਪਾਂ ਘਰ ਬੈਠੇ ਆਪਣੇ ਮੋਬਾਈਲਾਂ ਉੱਤੋਂ ਉਸ ਚੀਜ਼ ਨੂੰ ਲੱਭ ਸਕਦੇ ਹਾਂ ਵੈਬਸਾਈਟ ਨੂੰ ਲੱਭ ਸਕਦੇ ਹਾਂ ਸੋ ਇੱਦਾਂ ਹੀ ਜੇਕਰ ਅਸੀਂ ਕਿਤੇ ਸੜਕ 'ਤੇ ਜਾਂਦੇ ਹੋਈਏ ਸਾਡਾ ਐਕਸੀਡੈਂਟ ਹੋ ਗਿਆ ਹੋਵੇ ਤਾਂ ਸਰਕਾਰ ਨੇ ਗਲੀ ਗਲੀ 'ਚ ਨਹੀਂ ਕਹਿ ਸਕਦੇ ਆਪਾਂ ਮੁਹੱਲਿਆ ਮੁਹੱਲਿਆਂ ਵਿੱਚ ਜਾਂ ਵੱਡੇ ਵੱਡੇ ਜਿਹੜੇ ਹਾਈਵੇ ਹੁੰਦੇ ਹਨ ਉਹਨਾਂ ਉੱਤੇ ਉਹਨਾਂ ਨੇ ਆਪਣੇ ਨੰਬਰ ਮੈਨਸ਼ਨ ਕੀਤੇ ਹੁੰਦੇ ਹਨ ਜਿੰਨਾਂ ਦੌਰਾਨ ਸਾਨੂੰ ਪਤਾ ਲੱਗ ਸਕੇ ਸਾਡੀ ਟਾਈਮ ਸਿਰ ਸਹਾਇਤਾ ਹੋ ਸਕੇ ਸੋ ਇਹ ਟੈਲੀਮੈਡੀਸਨ ਹਨ ਜਿਵੇਂ ਡੋਕਟਰ ਸਾਡੇ ਘਰ ਆ ਜਾਂਦੇ ਹਨ ਅਤੇ ਸਾਡਾ ਟ੍ਰੀਟਮੈਂਟ ਵਧੀਆ ਹੋ ਜਾਂਦਾ ਹੈ